ਮੈਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੀ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਸ਼੍ਰੀ ਜੋਤੀ ਸਰੂਪ ਸਾਹਿਬ ਜਿਹੜਾ ਗੁਰਦਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਜੀ ਇੱਥੇ ਛੋਟ ਜ਼ਾਦ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ ਜੀ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਉਹਨਾਂ ਨੂੰ ਸੰਸਕਾਰ ਕੀਤਾ ਜੀ ਅਤੇ ਜਿਹੜੀਆ ਮੇਨ ਥਾਵਾਂ ਹਨ ਉਰੇ ਜਿਵੇਂ ਕੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਜੀ ਸ਼ੀਸ਼ ਗੰਜ ਮੋਤੀ ਰਾਮ ਮਹਿਰਾ ਜੀ ਜਿਵੇਂ ਟੋਡਰ ਮੱਲ ਦੀ ਹਵੇਲੀ 'ਤੇ ਜਿਹੜੀ ਜਿਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਸੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਸਭਾ ਭਰੀ ਜਾਂਦੀ ਜੀ ਇੱਥੇ ਬਾਰਵੇਂ ਮਹੀਨੇ ਵਿੱਚ ਦਸੰਬਰ ਮਹੀਨੇ 'ਚ ਪੋਹ ਦੇ ਮਹੀਨੇ 'ਚ ਜੀ ਇਹ ਧਰਮ ਬਾਰੇ ਇਹਨਾਂ ਨੂੰ ਕਰਿਆ ਸੀ ਧਰਮ ਨਹੀਂ ਇਹਨਾਂ ਨੇ ਉਹ ਕਰਿਆ ਆਪਣਾ ਹਾਰਿਆ ਜੀ ਅਤੇ ਅੜੇ ਰਹੇ ਜੀ